ਹੈਲੋ ਸਤਿ ਸ਼੍ਰੀ ਅਕਾਲ ਮੈਂ ਪਿੰਕੀ ਬੋਲਦੀ ਪਈ ਹਾਂ ਇਸਲਾਮਾਬਾਦ ਮੁਹੱਲੇ ਤੋਂ ਅਤੇ ਮੈਨੂੰ ਮੈਂ ਯੋਗਾ ਕਰਦੀ ਹਾਂ ਅਤੇ ਮੈਨੂੰ ਯੋਗਾ ਬੜਾ ਪਸੰਦ ਹੈ ਮਤਲਬ ਕਿ ਮੀਨਸ ਮੈਂ ਯੋਗਾ ਕਰਨ ਨਾਲ ਮੇਰਾ ਸਰੀਰ ਤੰਦਰੁਸਤ ਰਹਿੰਦਾ ਠੀਕ ਠਾਕ ਰਹਿੰਦਾ ਹੈ ਆ ਮਤਲਬ ਕਿ ਫਿੱਟ ਰਹਿੰਦਾ ਮੇਰਾ ਸਰੀਰ ਅਤੇ ਅਸੀਂ ਪੰਜ ਜੂਨ ਨੂੰ ਫਿਸ਼ ਪਾਰਕ ਗਏ ਸੀ ਉੱਥੇ ਅਸੀਂ ਯੋਗਾ ਯੋਗਾ ਦਿਵਸ ਮਨਾਇਆ ਸੀ ਅਤੇ ਉੱਥੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇੰਜੋਮੈਂਟ ਕੀਤਾ ਯੋਗਾ ਦਿਵਸ ਦਾ ਅਤੇ ਅਸੀਂ ਉੱਥੇ ਐਕਸਰਸਾਈਜ਼ ਕੀਤੀ ਬੜੀ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਉੱਥੇ ਬਹੁਤ ਵਧੀਆ ਸਾਨੂੰ ਲੱਗਿਆ ਅਤੇ ਮੈਂ ਹਾਲੇ ਤੱਕ ਵੀ ਉਹ ਉਹ ਦਿਨ ਨਹੀਂ ਮੈਂ ਆਪਣਾ ਭੁੱਲ ਸਕਦੀ ਯੋਗਾ ਦਿਵਸ ਵਾਲਾ ਅਸੀਂ ਬਹੁਤ ਵਧੀਆ ਤਰੀਕੇ ਨਾਲ ਉੱਥੇ ਫਿਸ਼ ਪਾਰਕ ਮਨਾਇਆ ਸੀ ਬਹੁਤ ਵਧੀਆ ਤਰੀਕੇ ਨਾਲ ਅਤੇ ਸਾਨੂੰ ਬਹੁਤ ਹੀ ਚੰਗਾ ਲੱਗਿਆ ਅਤੇ ਮੈਂ ਜਦੋਂ ਦਾ ਯੋਗਾ ਕਰਨਾ ਮੇਰਾ ਸਰੀਰ ਬਿਲਕੁਲ ਤੰਦਰੁਸਤ ਠੀਕ ਠਾਕ ਹੈਗਾ ਅਤੇ ਮਤਲਬ ਕਿ ਫਿਸ਼ ਪਾਰਕ ਜਿਹੜਾ ਇੰਜੋਇਮੈਂਟ ਕੀਤੀ ਸੀ ਯੋਗਾ ਦਿਵਸ ਦੀ ਉਹ ਮੈਂ ਹਾਲੇ ਤੱਕ ਵੀ ਨਹੀ ਮੈਨੂੰ ਭੁੱਲਦਾ ਉਹ ਬੜੀ ਵਧੀਆ ਤਰੀਕੇ ਨਾਲ ਬਹੁਤ ਮਜ਼ਾ ਆਇਆ ਆਪਣੀਆਂ ਸਹੇਲੀਆਂ ਨਾਲ ਅਸੀਂ ਕੀਤਾ ਸੀ ਉੱਥੇ